ਪੰਜਾਬ ਵਿੱਚ ਸਿਹਤ ਸੰਭਾਲ ਬੁਨਿਆਦੀ ਢਾਂਚੇ ਦੀ ਸਥਿਤੀ ਠੀਕ ਠਾਕ ਹੀ ਹੈ ਬਟ ਕੁਝ ਖਾਸ ਨਹੀਂ ਹੈ ਜਿਵੇਂ ਕਿ ਤੁਸੀਂ ਜਾਣਦੇ ਹੈ ਕਿ ਅੱਜ ਕੱਲ੍ਹ ਆਬਾਦੀ ਬਹੁਤ ਜ਼ਿਆਦਾ ਵੱਧ ਗਈ ਹੈ ਅਤੇ ਇਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਹਸਪਤਾਲ ਅਤੇ ਕਲੀਨਿਕ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਅੱਜ ਕੱਲ੍ਹ ਜਿਸ ਤਰ੍ਹਾਂ ਦਾ ਸਮਾਂ ਚੱਲ ਰਿਹਾ ਹੈ ਅਤੇ ਜਿਸ ਤਰ੍ਹਾਂ ਦਾ ਖਾਣ ਪੀਣ ਚੱਲ ਰਿਹਾ ਹੈ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਉਲਝਣਾ ਪੈ ਰਿਹਾ ਹੈ ਅਤੇ ਇਸਦੀ ਇਹਨਾਂ ਦੇ ਕਰਕੇ ਹੀ ਉਹ ਲੋਕ ਜੋ ਹੈ ਹਸਪਤਾਲਾਂ ਦੀ ਕਮੀ ਹੋ ਰਹੀ ਹੈ ਅਤੇ ਸੇ ਸਿਹਤ ਸੰਭਾਲ ਵਿੱਚ ਬਹੁਤ ਹੀ ਜ਼ਿਆਦਾ ਸੁਧਾਰ ਕਰਨ ਦੀ ਜ਼ਰੂਰਤ ਹੈ ਕਾਫੀ ਜਿਵੇਂ ਕਿ ਅਸੀਂ ਦੇਖਦੇ ਹੀ ਹਾਂ ਕਿ ਅੱਜ ਤੱਕ ਸਰਕਾਰੀ ਹੋਸਪੀਟਲਾਂ ਦਾ ਰੁਝਾਨ ਬਹੁਤ ਹੀ ਘੱਟ ਗਿਆ ਹੈ ਲੋਕ ਡਾਕਟਰਾਂ ਦੀ ਕਮੀ ਹੋਣ ਕਰਕੇ ਅਤੇ ਸਹੀ ਸਵਾਲ ਨਾ ਹੋਣ ਕਰਕੇ ਲੋਕ ਪ੍ਰਾਈਵੇਟ ਹੋਸਪਿਟਲਾਂ ਕਨੀ ਹਸਪਤਾਲਾਂ ਕਨੀ ਜਾ ਰਹੇ ਹਨ ਅਤੇ ਉੱਥੋਂ ਦੀ ਲੋਕਾਂ ਨੂੰ ਦੇਖ ਕੇ ਉੱਥੋਂ ਦੇ ਕਰਮਚਾਰੀਆਂ ਵੱਲ ਦੇਖ ਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ ਅਤੇ ਜਾਂ ਉਹ ਕਈ ਤਾਂ ਥਾਵਾਂ 'ਤੇ ਹੋਸਪਿਟਲ ਪਹੁੰਚ ਤੋਂ ਬਾਹਰ ਹੋਣ ਕਰਕੇ ਲੋਕ ਦੂ ਲੋਕਾਂ ਨੂੰ ਦੂਰ ਦੂਰ ਜਾਣਾ ਚਾਹੀਦਾ ਦੂਰ ਦੂਰ ਪਹੁੰਚਣਾ ਪੈਂਦਾ ਹੈ ਅਤੇ ਅੱਜ ਕੱਲ੍ਹ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਰ ਜਗ੍ਹਾ 'ਤੇ ਹਰ ਖੇਤਰ ਦੇ ਵਿੱਚ ਜੋ ਕੀ ਹੈ ਹੋਸਪਿਟਲ ਹਸਪਤਾਲ ਜੋ ਹੈ ਪ੍ਰੋਵਾਈਡ ਕਰ ਸਕਣ ਤਾਂ ਕਿ ਲੋਕਾਂ ਨੂੰ ਹੋਰ ਵੱਡੀਆਂ ਬਿਮਾਰੀਆਂ ਦੇ ਲਈ ਸ਼ਹਿਰੋਂ ਦੂਰ ਜਾਂ ਪਿੰਡੋ ਦੂਰ ਨਾ ਜਾਣਾ ਪਵੇ ਤਾਂ ਇਹ ਉਹ ਆਪਣੇ ਹੀ ਖੇਤਰ ਦੇ ਵਿੱਚ ਆਪਣਾ ਇਲਾਜ ਕਰਵਾ ਸਕਣ ਕੁਝ ਲੋਕ ਚਾਹੀਦਾ ਹੈ ਕਿ ਮੈਡੀਕਲ ਕਾਲਜ ਉੱਥੇ ਉਪਲਬਧ ਹੋ ਸਕਣ ਤਾਂ ਕਿ ਹਰ ਬੱਚਾ ਜੋ ਹੈ ਕਿ ਵਧੀਆ ਪੜ੍ਹਾਈ ਕਰ ਸਕੇ ਅਤੇ ਉੱਥੇ ਹ ਚਾਹੀਦਾ ਸਰਕਾਰ ਨੂੰ ਚਾਹੀਦਾ ਕਿ ਉਹ ਟਵੈਂਟੀ ਫ਼ੋਰ ਸੈਵੇਨ ਜੋ ਹੈ ਕਿ ਐਬੂਲੈਂਸ ਪ੍ਰੋਵਾਈਡ ਕਰ ਸਕਣ ਅਤੇ ਪਿੰਡਾਂ ਵਿੱਚ ਵੀ ਛੋਟੇ ਮੋਟੇ ਹਸਪਤਾਲ ਹੋ ਸਕਣ ਤਾਂ ਕਿ ਲੋਕਾਂ ਨੂੰ ਹੋਰ ਕਿਤੇ ਨਾ ਜਾਣਾ ਪਵੇ ਅਤੇ ਉਹਨਾਂ ਨੂੰ ਜੋ ਵੀ ਜ਼ਰੂਰਤਮੰਦ ਦੀਆਂ ਦਵਾਈਆਂ ਨੇ ਉਹ ਉੱਥੇ ਕਰਵਾ ਉਹ ਪ੍ਰੋਵਾਈਡ ਹੋ ਸਕਣ ਅਤੇ ਲੋਕ ਆਪਣੀ ਜੋ ਹੈ ਸਾਂਭ ਸੰਭਾਲ 'ਤੇ ਬਹੁਤ ਜ਼ਿਆਦਾ ਧਿਆਨ ਦੇ ਸਕਣ ਧੰਨਵਾਦ